ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਸਭ ਤੋਂ ਵਧੀਆ ਸਟਾਰ ਤਾਰੇ ਦੇਖਣਾ ਬਹੁਤ ਵਧੀਆ ਲੱਗਦਾ ਹੈ ਮੈਨੂੰ ਸਟਾਰ ਬਹੁਤ ਜ਼ਿਆਦਾ ਅੱਛੇ ਲੱਗਦੇ ਆ ਜਦੋਂ ਮੈਂ ਸਟਾਰ ਬਣਾਉਂਦੇ ਸੀਗੇ ਨਿੱਕੇ ਹੁੰਦੇ ਪੈਂਦੇ ਸੀਗੇ ਰਾਤ ਨੂੰ ਬਾਹਰ ਪੈਂਦੇ ਹੁੰਦੇ ਸੀ ਪਿਛਲੇ ਜਮਾਨੇ 'ਚ ਉਦੋਂ ਮੈਨੂੰ ਬਾਹਰ ਪੈਣਾ ਤਾਰੇ ਦੇਖਣਾ ਬਹੁਤ ਵਧੀਆ ਲੱਗਦਾ ਸੀਗਾ ਜਦੋਂ ਅਸੀਂ ਰਾਤ ਨੂੰ ਪੈਣਾ ਅਸੀਂ ਸਭ ਨੇ ਉੱਪਰ ਤਾਂ ਰੱਬ ਕੰਨੀ ਝਾਕੀ ਜਾਣਾ ਅਤੇ ਤਾਰੇ ਜਗਦੇ ਬੁਝ ਗਏ ਤਾਰੇ ਡਿੱਗ ਪੈਂਦੇ ਸਾਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਸਾਡੀ ਦਾਦੀ ਮਾਂ ਵੀ ਸਾਨੂੰ ਬਾ ਤਾਰਿਆਂ ਦੀ ਬਾਤਾਂ ਪਾਉਂਦੇ ਹੁੰਦੇ ਸੀਗੇ ਫਿਰ ਸਾਨੂੰ ਤਾਰਿਆਂ ਬਾਰੇ ਦੱਸਦੇ ਹੁੰਦੇ ਸੀਗੇ ਫਿਰ ਜਦੋਂ ਅਸੀਂ ਸਾਹਮਣੇ ਸਾਰੀ ਸਾਰੀ ਰਾਤ ਤਾਰੇ ਦੇਖਦੇ ਜਦੋਂ ਵੀ ਸਾਡੀ ਜਾਗ ਖੁੱਲ੍ਹ ਜਾਂਦੀ ਬਾਹਰ ਪੈਂਦੀ ਅਸੀਂ ਤਾਰੇ ਹੀ ਜ਼ਿਆਦਾ ਦੇਖਦੇ ਹਾਂ ਫਿਰ ਸਾਨੂੰ ਬਹੁਤ ਵਧੀਆ ਲੱਗਦੇ ਆ ਤਾਰੇ ਕਿਉਂਕਿ ਸਟਾਰ ਜਦੋਂ ਮੈਂ ਕੋਈ ਵੀ ਡਰਾਇੰਗ ਕਰਨੀ ਆ ਉਦੋਂ ਵੀ ਮੈਂ ਸਭ ਤੋਂ ਪਹਿਲਾਂ ਜ਼ਿਆਦਾ ਸ ਸਟਾਰ ਹੀ ਬਾਹੁੰਦੀ ਹਾਂ ਤਾਰੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਘਰ ਦੇ ਵਿੱਚ ਵੀ ਛੱਤਾਂ 'ਤੇ ਮੇਰਾ ਤਾਰੇ ਹੀ ਲਗਾਏ ਆ ਲੈ ਕੇ ਮੈਨੂੰ ਵਧੀਆ ਕੰਧਾਂ 'ਤੇ ਵੀ ਤਾਰੇ ਲਗਾਏ ਆ ਮੈਨੂੰ ਜ਼ਿਆਦਾ ਤਾਰਿਆਂ ਦਾ ਜ਼ਿਆਦਾ ਸ਼ੌਂਕ ਆ